ਸਤਿ ਸ਼੍ਰੀ ਅਕਾਲ ਜੀ ਸਾਡੇ ਖੇਤਰ ਦੇ ਨੇੜਲੇ ਵਿੱਚ ਜਿਵੇਂ ਬਾਬਾ ਸਾਹਿਬ ਬਜ਼ਾਰ ਹੈ ਦਰਬਾਰ ਸਾਹਿਬ ਦੇ ਕੋਲ ਉਸ ਵਿੱਚ ਬਹੁਤ ਤਰ੍ਹਾਂ ਦੀਆਂ ਵਰਾਇਟੀਆਂ ਹਨ ਜਿਵੇਂ ਕਿ ਸੂਟਾਂ ਦੀਆਂ ਦੁਕਾਨਾਂ ਜੁੱਤੀਆਂ ਦੀਆਂ ਦੁਕਾਨਾਂ ਪੰਜਾਬੀ ਜੁੱਤੀਆਂ ਦੀਆਂ ਦੁਕਾਨਾਂ ਖਾਣ ਪੀਣ ਦੀਆਂ ਦੁਕਾਨਾਂ ਕਰੋਕਰੀ ਇਸ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਹਨ ਜਿਵੇਂ ਕਿ ਦਿੱਲੀ ਵਾਲਿਆਂ ਦੀ ਸੇਲ ਉੱਥੇ ਤਾਂ ਵੀਹ ਵੀਹ ਰੁਪਏ ਦੇ ਹਰ ਇੱਕ ਕਿਸਮ ਦਾ ਸਮਾਨ ਜਨਾਨੀਆਂ ਦੀ ਲੋੜ ਅਨੁਸਾਰ ਮਿਲਦਾ ਹੈ ਲਿਪਸਟਿਕ ਬਿੰਦੀ ਨੇਲ ਪੋਲਿਸ਼ ਕਾਂਟੇ ਕੜੇ ਸਭ ਕੁੱਛ ਮਿਲਦਾ ਹੈ ਉੱਥੇ ਮਹਿੰਦੀ ਵਗੈਰਾ ਸਭ ਕੁਛ ਮਿਲਦਾ ਹੈ ਜਿਵੇਂ ਕਿ ਹੁਣ ਇੱਥੇ ਪੰਜਾਬੀ ਜੁੱਤੀਆਂ ਦੀ ਵਰਾਇਟੀ ਹੀ ਤੁਸੀਂ ਲਾ ਲਓ ਇੰਨੀ ਵਧੀਆ ਪੰਜਾਬੀ ਜੁੱਤੀਆਂ ਦੀ ਵਰਾਇਟੀ ਹੈ ਅਤੇ ਉਹ ਮਿਲਦੀ ਵੀ ਬੜੀ ਸਸਤੀ ਸੌ ਸੌ ਰੁਪਏ ਵਿੱਚ ਫੁਲਕਾਰੀ ਜਿਵੇਂ ਕੁੜੀਆਂ ਅੱਜ ਕੱਲ੍ਹ ਸੂਟਾਂ ਦੇ ਉੱਤੇ ਫੁਲਕਾਰੀ ਲੈਂਦੀਆਂ ਨੇ ਉਹ ਵੀ ਬਹੁਤ ਵਧੀਆ ਹੁਣ ਆਪਣੇ ਜਿਵੇਂ ਮਨਸੂਰੀ ਵਾਲੀ ਸਾਈਡ 'ਤੇ ਚਲੇ ਜਾਂਦੇ ਹਾਂ ਅਤੇ ਉੱਥੇ ਅਸੀਂ ਜਦੋਂ ਕੋਈ ਸ਼ੋਪਿੰਗ ਕਰਨ ਜਾਂਦੇ ਹਾਂ ਤਾਂ ਉੱਥੇ ਕਿੰਨਾ ਮਹਿੰਗਾ ਸਮਾਨ ਮਿਲਦਾ ਲੇਕਿਨ ਸਾਡੇ ਇੱਥੇ ਪੰਜਾਬ ਵਿੱਚ ਬੜਾ ਸਸਤਾ ਅਤੇ ਵਧੀਆ ਸਮਾਨ ਮਿਲਦਾ ਹੈ ਹੁਣ ਅਸੀਂ ਬਾਜ਼ਾਰਾਂ ਵਿੱਚ ਹਰੇਕ ਤਰ੍ਹਾਂ ਦੀਆਂ ਦਰਬਾਰ ਸਾਹਿਬ ਦੇ ਲਾਗੋਂ ਚੀਜ਼ਾਂ ਖਰੀਦੀਏ ਤਾਂ ਸਾਨੂੰ ਕੋਈ ਜ਼ਿਆਦਾ ਰੇਟ ਨਹੀਂ ਮਿਲਦਾ ਯਾਨੀ ਕਿ ਜੈਨ ਸਹੀ ਰੇਟ ਵਿੱਚ ਚੀਜ਼ਾਂ ਮਿਲਦੀਆਂ ਨੇ ਅਤੇ ਮੈਨੂੰ ਉੱਥੇ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਖਾਧੀ ਕੇ ਵੇਖੀਆਂ ਅਤੇ ਉਹ ਵੀ ਬਹੁਤ ਹੀ ਸਵਾਦ ਹੁੰਦੀਆਂ ਨੇ ਜਿਵੇਂ ਕਿ ਜਾਓ ਅਤੇ ਉੱਥੇ ਨੁੱਕਰ 'ਤੇ ਇੱਕ ਗਲੀ ਦੇ ਮੋੜ 'ਤੇ ਪਕੌੜਿਆਂ ਵਾਲੀ ਦੁਕਾਨ ਉੱਥੋਂ ਦੇ ਤਾਂ ਪਕੌੜੇ ਵੀ ਇੰਨੇ ਮਸ਼ਹੂਰ ਨੇ ਖ਼ਾਸ ਕਾਰਨ ਗਰਮੀਆਂ ਵਿੱਚ ਉੱਥੋਂ ਕੁਲਫ਼ੀ ਵੀ ਅਸੀਂ ਖਾ ਕੇ ਵੇਖੀ ਸਾਨੂੰ ਕੁਲਫ਼ੀ ਵੀ ਬੜੀ ਸਵਾਦ ਲੱਗਦੀ ਹੈ ਮਟਕੇ ਵਾਲੀ ਕੁਲਫ਼ੀ ਅਤੇ ਲਾਗੇ ਹੀ ਉਹਦੇ ਭਰਾਵਾਂ ਦਾ ਢਾਬਾ ਵੀ ਹੈ ਉੱਥੋਂ ਦੀ ਵੀ ਅਸੀਂ ਰੋਟੀ ਖਾਧੀ ਹੋਈ ਹੈ ਅਤੇ ਉਹ ਵੀ ਬੜੀ ਸਵਾਦ ਹੀ ਮਿਲਦੀ ਹੈ ਅਤੇ ਮੇਰਾ ਤਾਂ ਇਹੀ ਜੀ ਹੈ ਕਿ ਸਾਡੇ ਦਰਬਾਰ ਸਾਹਿਬ ਬਾਬਾ ਸਾਹਿਬ ਵਾਲੇ ਚੌਂਕ 'ਚ ਹਰੇਕ ਚੀਜ਼ ਬਹੁਤ ਹੀ ਵਧੀਆ ਅਤੇ ਸਸਤੀ ਪਾਈ ਜਾਂਦੀ ਹੈ ਧੰਨਵਾਦ